ਸਾਡੇ ਘਰ ਵਿੱਚ ਚੌਵੀ ਘੰਟੇ ਬਿਜਲੀ ਰਹਿੰਦੀ ਹੈ ਸਰਦੀਆਂ ਦੇ ਵਿੱਚ ਸਾਰਾ ਸਮਾਂ ਬਿਜਲੀ ਰਹਿੰਦੀ ਹੈ ਅਤੇ ਗਰਮੀਆਂ ਦੇ ਵਿੱਚ ਕੱਟ ਲੱਗਦੇ ਹਨ